ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਹਾਂਜੀ ਮੈਮ ਸਤਿ ਸ਼੍ਰੀ ਅਕਾਲ ਹਾਂਜੀ ਹਾਂ ਸਭ ਠੀਕ ਹੈ ਤੁਸੀਂ ਸੁਣਾਓ ਹਾਂਜੀ ਹਾਂਜੀ ਹਾਂਜੀ ਜੀ ਹਾਂਜੀ ਕਾਲਜ ਦੇਖੋ ਜੀ ਕਾਫੀ ਵਧੀਆ ਸਾਡੇ ਇੱਥੇ ਅਮਨ ਭੱਲਾ ਕੋਲਜ ਹੈ ਲਾਗੇ ਸਾਡੇ ਏ ਬੀ ਕੋਲਜ ਪੈਂਦਾ ਇੱਕ ਸ਼੍ਰੀ ਸਾਈ ਕੋਲਜ ਆ ਸਾਰੇ ਵਧੀਆ ਤਿੰਨ ਚਾਰ ਕਾਲਜ ਵਧੀਆ ਐਜੂਕੇਸ਼ਨ ਵੀ ਵਧੀਆ ਜੀ ਉਹਨਾਂ ਦੀ ਹਾਂਜੀ ਅਤੇ ਕੋਈ ਨਹੀਂ ਜਦੋਂ ਤੁਸੀਂ ਲੈਣੀ ਤਾਂ ਕੋਂਟੈਕਟ ਕਰ ਲਿਓ ਤਾਂ ਮੈਂ ਤੁਹਾਨੂੰ ਲੈ ਜਾਂਗਾ ਨਾਲ ਚਲ ਪਾਂਗਾ ਹਾਂਜੀ ਮੈਂ ਸ਼੍ਰੀ ਸਾਈ ਕੋਲਜ ਪੜ੍ਹਦਾ ਜੀ ਹਾਂਜੀ ਮੈਂ ਹਾਂਜੀ ਹਾਂਜੀ ਕੋਈ ਨਹੀਂ ਤੁਸੀਂ ਆ ਜਾਇਓ ਨੈਕਸਟ ਮੰਡੇ ਆ ਜਾਇਓ ਤੁਸੀਂ ਅਤੇ ਜਦੋਂ ਜਾਣਾ ਹੋਊਗਾ ਤਾਂ ਮੈਂ ਨਾਲ ਚੱਲ ਪਉਂਗਾ ਤੁਹਾਡੀ ਹੈਲਪ ਲਈ ਸਾਰੇ ਹੀ ਬਹੁਤ ਵਧੀਆ ਜੀ ਟੀਚਰ ਬਹੁਤ ਵਧੀਆ ਗਾਈਡ ਕਰਦੇ ਬਹੁਤ ਪ੍ਰੋਪਰ ਗਾਈਡ ਕਰਦੇ ਆ ਹਾਂ ਐਜੂਕੇਸ਼ ਐਜੂਕੇਸ਼ਨ ਵੀ ਬਹੁਤ ਵਧੀਆ ਉਹਨਾਂ ਦੀ ਬਾਕੀ ਉਹਨਾਂ ਦੀ ਬੱਸ ਬੱਸਾਂ ਲੱਗੀਆਂ ਹੋਈਆਂ ਗੇਟ ਦੇ ਬਾਹਰ ਬੱਸ ਆ ਜਾਂਦੀ ਇੱਥੋਂ ਬੈਠੋ ਅਤੇ ਘਰ ਛੱਡ ਦਿੰਦੇ ਆ ਉਹ ਬੱਸਾਂ ਲੱਗੀਆਂ ਹੋਈਆਂ ਕੁਲਵੰਤ ਦਾ ਪੂਰਾ ਕੀਤੇ ਦਾ ਆਪਣਾ ਸਿਸਟਮ ਉਹਨਾਂ ਪੂਰਾ ਵਧੀਆ ਬਹੁਤ ਵਧੀਆ ਪ੍ਰੋਪਰ ਚੱਲ ਰਿਹਾ ਹਾਂ ਬਾਕੀ ਟੀਚਰ ਵੀ ਵਧੀਆ ਸਾਰੇ ਓਕੇ ਜੀ ਓਕੇ ਜੀ ਓਕੇ